ਮੈਂ ਪੀ ਐੱਚ ਡੀ ਦਾ ਰਿਸਰਚ ਸਕੋਲਰ ਹੋਣ ਦੇ ਨਾਤੇ ਪੰਜਾਬੀ ਦਾ ਖੋਜਾਰਥੀ ਹੋਣ ਦੇ ਨਾਤੇ ਕਿਤਾਬਾਂ ਤੋਂ ਇਲਾਵਾ ਵੀ ਬਹੁਤ ਸਾਰੇ ਰਸਾਲਿਆਂ ਦਾ ਮੈਗਜ਼ੀਨਾਂ ਦਾ ਬਲੋਗਾਂ ਦਾ ਅਖ਼ਬਾਰਾਂ ਦਾ ਸਹਾਰਾ ਲੈਂਦਾ ਰਹਿੰਦਾ ਤਾਂ ਜੋ ਆਪਣੇ ਆਪ ਨੂੰ ਲਗਾਤਾਰ ਅੱਪਡੇਟ ਰੱਖ ਸਕਾਂ ਲਗਾਤਾਰ ਆਪਣੇ ਆਪ ਨੂੰ ਨਵਿਆਉਂਦਾ ਰਹਾਂ ਇਸ ਲਈ ਮੈਂ ਲਗਾਤਾਰ ਪੰਜਾਬੀ ਦੇ ਵਿੱਚ ਨਿਕਲ ਰਹੇ ਦੈਨਿਕ ਹਫ਼ਤਾਵਾਰੀ ਪੰਦਰਵਾੜੇ ਰਾਹੀਂ ਤਿਮਾਹੀ ਛਿਮਾਹੀ ਸਾਲਾਨਾ ਰਸਾਲਿਆਂ ਨੂੰ ਪੜ੍ਹਦਾ ਰਹਿੰਦਾ ਜਿਸਦੇ ਵਿੱਚ ਮੁੱਖ ਤੌਰ 'ਤੇ ਮੇਰੇ ਦੋ ਅਖ਼ਬਾਰ ਨਵਾਂ ਜ਼ਮਾਨਾ ਅਤੇ ਪੰਜਾਬੀ ਟ੍ਰਿਬਿਊਨ ਸਾਹਿਤ ਨਾਲ ਸੰਬੰਧਿਤ ਬਹੁਤ ਸਾਰੀ ਸਮੱਗਰੀ ਜਿਹੜੀ ਮੁਹੱਈਆ ਕਰਵਾਉਂਦੇ ਹੈ ਉਨ੍ਹਾਂ ਨੂੰ ਪੜ੍ਹਦੇ ਰਹਿਣ ਨਾਲ ਤੁਸੀਂ ਲਗਾਤਾਰ ਨਵੀਆਂ ਚੀਜ਼ਾਂ ਬਾਰੇ ਨਵੀਆਂ ਕਿਤਾਬਾਂ ਬਾਰੇ ਨਵੇਂ ਗਿਆਨ ਤੋਂ ਜਾਣੂ ਹੁੰਦੇ ਰਹਿੰਦੇ ਹੋ ਇਸ ਲਈ ਮੈਂ ਰੋ ਪੰਜਾਬੀ ਦੇ ਵਿੱਚ ਨਿਕਲਣ ਬਾਰੇ ਅਖ਼ਬਾਰਾਂ ਨੂੰ ਵੀ ਪੜ੍ਹਦਾ ਹਾਂ ਇਸ ਤੋਂ ਇਲਾਵਾ ਪੰਜਾਬੀ ਦੇ ਵਿੱਚ ਬਹੁਤ ਵਧੀਆ ਮੈਗਜ਼ੀਨ ਜਿਹੜੇ ਹੈ ਉਹ ਚਲਾਏ ਜਾ ਰਹੇ ਹੈ ਕਈ ਮੈਗਜ਼ੀਨ ਨੌਜਵਾਨਾਂ ਦੁਆਰਾ ਵੀ ਚਲਾਏ ਜਾ ਰਹੇ ਹੈ ਕਈ ਸਾਹਿਤਿਕ ਸੰਸਥਾਵਾਂ ਦੁਆਰਾ ਵੀ ਚਲਾਏ ਜਾ ਰਹੇ ਹੈ ਜਿਨ੍ਹਾਂ ਦੇ ਵਿੱਚੋਂ ਮੈਂ ਮੁੱਖ ਤੌਰ 'ਤੇ ਤਰਜੀਹ ਦਿੰਦਾ ਹੁਣ ਫਿਲਹਾਲ ਰਾਗ ਕਹਾਣੀ ਤਾਰਾ ਸੰਵਾਦ ਅਤੇ ਇੱਕ ਹੁਣ ਨਵਾਂ ਰਸਾਲਾ ਨਿਕਲ ਰਿਹਾ ਸੁਰਤ ਉਨ੍ਹਾਂ ਨੂੰ ਮੈਂ ਲਗਾਤਾਰ ਪੜ੍ਹਦਾ ਰਹਿੰਦਾ ਹਾਂ ਉਨ੍ਹਾਂ ਵਿੱਚੋਂ ਲਗਾਤਾਰ ਗਿਆਨ ਹਾਸਲ ਕਰਦਾ ਰਹਿੰਦਾ ਹਾਂ